ਕੱਲ੍ਹ ਮੈਨੂੰ ਮੇਰੇ ਮਿੱਤਰ ਦਾ ਅੰਮ੍ਰਿਤਸਰ ਤੋਂ ਫੋਨ ਆਇਆ ਉਸਨੇ ਮੈਨੂੰ ਆਪਣੇ ਵਿਆਹ ਦੀ ਆ ਪਾ ਰਿਸੈਪਸ਼ਨ ਪਾਰਟੀ ਲਈ ਇਨਵਾਈਟ ਕੀਤਾ ਅਤੇ ਮੈਂ ਦੇਰ ਰਾਤ ਅੰਮ੍ਰਿਤਸਰ ਜਾਣਾ ਸੀ ਇਸ ਲਈ ਮੈਂ ਆਪਣੇ ਪਿੰਡ ਦੇ ਯਾਰ ਦੋਸਤ ਮਲਕੀਤ ਨੂੰ ਫੋਨ ਕੀਤਾ ਉਸਦਾ ਆਪਣਾ ਆਟੋ ਹੈ ਉਸ ਨੂੰ ਫੋਨ ਕਰਕੇ ਮੈਂ ਉਹਨੂੰ ਕਿਹਾ ਵੀ ਹਾਂ ਬਾਈ ਕੀ ਹਾਲ ਆ ਮਲਕੀਤ ਸਿੰਘ ਠੀਕ ਹੋ ਅਤੇ ਉਹ ਅੱਗੇ ਕਹਿੰਦਾ ਹਾਂਜੀ ਠੀਕ ਹੈ ਕਹਿੰਦਾ ਦੱਸੋ ਜੀ ਮੈਂ ਕਿਹਾ ਮੈਂ ਬੱਸ ਅੱਡੇ ਤੱਕ ਜਾਣਾ ਮੇਰੇ ਤੋਂ ਬੱਸ ਅੱਡਾ ਦਸ ਪਿੰਡ ਤੋਂ ਦਸ ਕਿਲੋਮੀਟਰ ਦੂਰ ਆ ਅਤੇ ਤੂੰ ਮੈਨੂੰ ਰਾਤ ਨੂੰ ਬਾਰ੍ਹਾਂ ਵਜੇ ਉੱਥੇ ਬੱਸ ਅੱਡੇ 'ਤੇ ਛੱਡ ਕੇ ਆਉਣਾ ਉਹ ਮੈਨੂੰ ਕਹਿੰਦਾ ਵੀ ਕੀ ਹੋ ਗਿਆ ਮੈਂ ਕਿਹਾ ਨਹੀਂ ਕੁਛ ਨਹੀਂ ਹੋਇਆ ਵੀ ਮੇਰਾ ਇੱਕ ਵਿਆਹ ਦੇ ਪ੍ਰੋਗਰਾਮ 'ਚ ਜਾਣਾ ਵੀ ਤੁਸੀਂ ਮੈਨੂੰ ਛੱਡ ਕੇ ਆਓ ਉਹ ਕਹਿੰਦਾ ਠੀਕ ਆ ਅਤੇ ਉਸ ਨੂੰ ਮੈਂ ਪੁੱਛਿਆ ਕਿੰਨੇ ਪੈਸੇ ਉਹ ਕਹਿੰਦਾ ਕੋਈ ਨਹੀਂ ਮੈਂ ਕਿਹਾ ਨਹੀਂ ਨਹੀਂ ਦੱਸੋ ਕਿੰਨਾ ਪੈਸੇ ਉਹਨੇ ਮੇਰੇ ਤੋਂ ਦ ਰਾਤ ਹੋਣ ਕਰਕੇ ਪੰਜਾਹ ਰੁਪਏ ਮੰਗੇ ਅਤੇ ਮੈਂ ਉਹਨੂੰ ਕਿਹਾ ਚਲੋ ਠੀਕ ਆ ਵੀ ਤੁਸੀਂ ਮੇਰੇ ਤੋਂ ਪ ਮੇਰੇ ਘਰ ਆ ਜਿਓ ਅਤੇ ਆਪਾਂ ਪਹਿਲਾਂ ਫਰੈਸ਼ ਹੋ ਕੇ ਚਾਹ ਚੂ ਪੀ ਕੇ ਫਿਰ ਚੱਲਾਂਗੇ ਤਾਂ ਥੋੜ੍ਹਾ ਜਿਹਾ ਟਾਈਮ ਉਹ ਮੇਰੇ ਕੋਲ ਅੱਧਾ ਘੰਟਾ ਪਹਿਲਾਂ ਆ ਗਿਆ ਮੇਰੇ ਘਰ ਅਤੇ ਅਸੀਂ ਬੈਠੇ ਰਹੇ ਅੱਧਾ ਘੰਟਾ ਵੇਟ ਕਰੀ ਵੀ ਜਦੋਂ ਮੈਂ ਤੁਰਨਾ ਸੀਗਾ ਮੇਰੀ ਬੱਸ ਦਾ ਟਾਈਮ ਸੀਗਾ ਸਾਢੇ ਬਾਰ੍ਹਾਂ ਪੋਣੇ ਇੱਕ ਦੇ ਨੇੜੇ ਤੇੜੇ ਅਤੇ ਉਹ ਫਿਰ ਅਸੀਂ ਦੋਨੋ ਜਣੇ ਚਲੇ ਗਏ ਸਾਢੇ ਬਾਰ੍ਹਾਂ ਵਜੇ ਅਸੀਂ ਤੁਰੇ ਅਤੇ ਹੌਲੀ ਹੌਲੀ ਰਾਤ ਦਾ ਹਨੇਰਾ ਸੀਗਾ ਅਸੀਂ ਉੱਥੇ ਜਨ 'ਤੇ ਪਹੁੰਚੇ ਅਤੇ ਚਲੋ ਪਹੁੰਚੇ ਤਾਂ ਮੇਰੀ ਬੱਸ ਅ ਰਾਈਟ ਟਾਈਮ 'ਤੇ ਆ ਚੁੱਕੀ ਸੀ ਅਤੇ ਮੈਂ ਉਸ ਵਿੱਚ ਬੈਠ ਕੇ ਆਪਣੇ ਆਟੋ ਵਾਲੇ ਉਹਨੂੰ ਪੇਮੈਂਟ ਕਰਕੇ ਬੱਸ ਚੜ੍ਹ ਕੇ ਆਪਣਾ ਅੰਮ੍ਰਿਤਸਰ ਚਲੇ ਗਿਆ